ਸਤਿ ਸ਼੍ਰੀ ਅਕਾਲ ਮੈਂ ਨਾ ਵੀਹ ਪੱਚੀ ਦਿਨਾਂ ਪਹਿਲਾਂ ਆਪਣਾ ਆਡਰ ਕੀਤਾ ਸੀਗਾ ਲੈਪਟੋਪ ਐਚ ਪੀ ਕੰਪਨੀ ਤੋਂ ਆਡਰ ਕੀਤਾ ਸੀ ਮੈਂ ਉਹਨਾਂ ਦੀ ਵੈਬਸਾਈਟ ਤੋਂ ਅਤੇ ਉੱਥੇ ਨਾ ਮੈਨੂੰ ਸ਼ੋ ਹੋ ਰਿਹਾ ਸੀਗਾ ਕਿ ਮੇਰਾ ਚਾਰ ਪੰਜ ਦਿਨਾਂ ਵਿੱਚ ਆ ਜਾਉ ਆਡਰ ਬਟ ਮੈਨੂੰ ਆਡਰ ਬਹੁਤ ਲੇਟ ਡਿਲੀਵਰ ਹੋਇਆ ਮੈਨੂੰ ਆਲਮੋਸਟ ਪੰਦਰਾਂ ਤੋਂ ਵੀਹ ਦਿਨਾਂ ਬਾਅਦ ਡਿਲੀਵਰ ਹੋਇਆ ਸੀ ਮੇਰਾ ਆਡਰ ਅਤੇ ਹੁਣ ਮੈਂ ਜਦੋਂ ਇਹਨੂੰ ਓਪਨ ਕੀਤਾ ਤਾਂ ਉਹ ਸਾਰਾ ਟੁੱਟਿਆ ਹੋਇਆ ਸੀ ਉਹਦੀਆਂ ਕੀਜ਼ ਨਿਕਲੀਆਂ ਹੋਈਆਂ ਵਾ ਉਹਦੇ ਪੋ ਪੋਰਟਸ ਵਗੈਰਾ ਸਾਫ਼ ਨਹੀਂ ਹੈਗੇ ਤਾਂ ਉਹਦੀ ਸਕਰੀਨ ਵੀ ਜਿਹੜੀ ਹੈਗੀ ਆ ਉਹ 'ਤੇ ਵੀ ਇੱਕ ਬਲੈਕ ਲਾਈਨ ਆ ਰਹੀ ਆ ਅਤੇ ਮੈਂ ਬੜਾ ਮਹਿੰਗਾ ਲੈਪਟਾਪ ਲਿੱਤਾ ਸੀਗਾ ਅਤੇ ਟਰੱਸਟ ਕਰਕੇ ਲਿੱਤਾ ਸੀ ਪਰ ਹਜੇ ਤੱਕ ਉਹਦਾ ਕੋਈ ਮੈਂ ਕਸਟਮਰ ਕੇਅਰ ਨੂੰ ਵੀ ਕੰਟੈਕਟ ਕੀਤਾ ਸੀ ਪਰ ਹਜੇ ਤੱਕ ਕੋਈ ਉਹਨਾਂ ਦਾ ਵੀ ਉਹਨਾਂ ਵੱਲੋਂ ਵੀ ਮੈਨੂੰ ਕੋਈ ਆਨਸਰ ਨਹੀਂ ਆ ਰਿਹਾ ਅਤੇ ਮੇਰਾ ਐਕਸਪੀਰੀਅੰਸ ਬਹੁਤ ਮਾੜਾ ਰਿਹਾ ਆਪਣੀ ਇਹ ਵੈਬਸਾਈਟ ਨਾਲ ਮੇਰੇ ਲੈਪ ਮੈਂ ਅੱਜ ਤੋਂ ਕਦੀ ਨਹੀਂ ਮੰਗਾਉਣਾ ਇਹਨਾਂ ਦਾ ਲੈਪਟਾਪ